ਦੇਖਿਆ ਜਾਏ ਤਾਂ ਟੈਕਨੋਲਜੀ ਦੇ ਯੂਜ਼ ਨਾਲ ਬੈਂਕਿੰਗ ਸਾਡਾ ਜੋ ਬੈਂਕਿੰਗ ਸਿਸਟਮ ਹੈ ਉਹ ਬਹੁਤ ਜ਼ਿਆਦਾ ਇਸ ਆਸਾਨ ਹੋ ਗਿਆ ਇਹਦੇ ਨਾਲ ਅਸੀਂ ਇੱਕ ਕਲਿੱਕ ਦੇ ਵਿੱਚ ਪੈਸੇ ਭੇਜ ਸਕਦੇ ਹਨ ਜਾਂ ਪੈਸੇ ਕਿਸੇ ਤੋਂ ਵੀ ਮੰਗਾ ਸਕਦੇ ਹਨ ਆਪਣਾ ਖਾਤਾ ਆਪਾਂ ਘਰ ਬੈਠੇ ਬੈਠੇ ਹੀ ਚੈੱਕ ਕਰ ਸਕਦੇ ਹਾਂ ਬੈਂਕਿੰਗ ਇੰਟਰਨੈਟ ਦੇ ਨਾਲ ਅਤੇ ਤਕਨੀਕੀ ਜਿਹੜੇ ਆਪਣੇ ਬੈਂਕਿੰਗ ਉਹਦੇ ਕਰਕੇ ਸ ਅਸੀਂ ਘਰ ਦੇ ਵਿੱਚ ਬੈਠੇ ਬੈਠੇ ਹੀ ਆਪਣੀ ਜਿਹੜੀ ਸਰਵਿਸਸ ਹੈਗੀਆਂ ਜਿਹਨਾਂ ਕਰਕੇ ਸਾਨੂੰ ਬੈਂਕ 'ਚ ਜਾਣਾ ਪੈਂਦਾ ਸੀ ਉਹ ਘਰੇ ਵੀ ਆਪਾਂ ਇਸਤੇਮਾਲ ਕਰ ਸਕਦੇ ਹਾਂ ਇਸ ਦੇ ਨਾਲ ਨਾਲ ਇਸ ਦੇ ਕੁਝ ਨੁਕਸਾਨ ਵੀ ਹਨ ਜਿਵੇਂ ਕਿ ਅੱਜ ਕੱਲ੍ਹ ਫਰੋਡ ਓਨਲਾਈਨ ਫਰੋਡਸ ਬਹੁਤ ਜ਼ਿਆਦਾ ਵੱਧ ਗਏ ਹਨ ਕਿਉਂਕਿ ਲੋਕ ਓ ਟੀ ਪੀ ਜਾਂ ਮੈਸੇਜ ਜਿਹੜੇ ਹੈਗੇ ਆ ਉਹ ਹੈਕ ਕਰਕੇ ਲੋਕਾਂ ਦੇ ਫੋਨਾਂ ਦੇ ਉਹ ਆਪਣਾ ਮਿਸਯੂਸ ਕਰਦੇ ਨੇ ਪਹਿਲਾਂ ਜਦੋਂ ਬੰਦਾ ਜਾਂਦਾ ਸੀ ਆਪ ਵੈਰੀਫਿਕੇਸ਼ਨ ਕਰਦਾ ਸੀ ਉਹਦੀ ਫੋਟੋ ਮੈਚ ਕੀਤੀ ਜਾਂਦੀ ਸੀ ਅਤੇ ਉਹ ਸਿਗਨੇਚਰ ਕਰਦਾ ਸੀ ਫਿਰ ਹੀ ਪੈਸੇ ਕਢਾ ਸਕਦਾ ਸੀ ਪਰ ਅੱਜ ਤਕਨੀਕੀ ਯੂਸ ਕਰਨ ਦੇ ਨਾਲ ਉਹਨੂੰ ਉੱਥੇ ਜਾਣ ਦੀ ਨਾਲ ਲੋੜ ਹੈਗੀ ਹੈ ਨਾ ਉਹਨੂੰ ਫੋਟੋ ਕਰਨ ਦੀ ਲੋੜ ਹੈਗੀ ਆ ਉਹ ਬਸ ਬੈਠੇ ਬੈਠੇ ਕੁਛ ਡਿਜਿਟਸ ਨੰਬਰ ਆਪਣੇ ਜਾਂ ਕੋਡਸ ਪਾ ਕੇ ਜਿਹੜਾ ਬੈਂਕ 'ਚ ਪੈਸੇ ਕਢਾ ਸਕਦਾ ਆ ਜੋ ਕਿ ਇੱਕ ਹਿਸਾਬ ਨਾਲ ਸਾਡੇ ਲਈ ਬਹੁਤ ਸਹੂਲਤਕਾਰੀ ਵੀ ਹੈ ਅਤੇ ਦੂਜੇ ਨਾਲ ਨਾਲ ਉਹ ਸਾਡੇ ਨੁਕਸਾਨ ਵੀ ਕਈ ਵਾਰੀ ਕਰ ਜਾਂਦਾ ਹੈ ਕਿਉਂਕਿ ਕਈ ਬੰਦੇ ਜਿਹੜੇ ਐਕਸਪਰਟਸ ਹੈਗੇ ਇਹਨਾਂ ਚੀਜ਼ਾਂ 'ਚ ਉਹ ਇਸ ਦਾ ਮਿਸਯੂਸ ਕਰ ਲੈਂਦੇ ਨੇ